ਹਾਂ ਅਸੀਂ ਸਰਕਾਰ ਦੀਆਂ ਸਕੀਮਾਂ ਜਾਂ ਪਹਿਲਕਦਮੀਆਂ ਤੋਂ ਜਾਣੂ ਹਾਂ ਜੋ ਸਿਹਤ ਸੰਭਾਲ ਲਾਭ ਪ੍ਰਦਾਨ ਕਰਦੀਆਂ ਹਨ ਸਰਕਾਰ ਵੱਲੋਂ ਚਲਾਇਆ ਗਿਆ ਹੈਲਥ ਬੀਮਾ ਯੋਜਨਾ ਸਾਡੇ ਪੂਰੇ ਪਰਿਵਾਰ ਦਾ ਬਣਿਆ ਹੋਇਆ ਉਸ ਬੀਮਾ ਯੋਜਨਾ ਰਾਹੀਂ ਸਾਨੂੰ ਬਹੁਤ ਜ਼ਿਆਦਾ ਲਾਭ ਮਿਲਿਆ ਹੈ ਮੇਰੇ ਦਾਦੀ ਜੀ ਦੀ ਤਬੀਅਤ ਖਰਾਬ ਰਹਿੰਦੀ ਸੀ ਉਹਨਾਂ ਦਾ ਆਪਰੇਸ਼ਨ ਹੋਣਾ ਸੀ ਉਹਨਾਂ ਨੇ ਆਪਣੀ ਅੱਖ ਦੀ ਸਰਜਰੀ ਕਰਵਾਈ ਸੀ ਅੱਖ ਦੀ ਸਰਜਰੀ ਉਸ ਕਾਰਡ ਰਾਹੀਂ ਹੋਈ ਸੀ ਅਸੀਂ ਸਰਕਾਰ ਨੂੰ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਸ ਨੇ ਅ ਇਸ ਬੀਮਾ ਯੋਜਨਾ ਚਲਾਇਆ ਜਿਸ ਨਾਲ ਅਸੀਂ ਆਪਣੀ ਦਾਦੀ ਜੀ ਦਾ ਮੁਫ਼ਤ ਇਲਾਜ ਕਰਵਾ ਸਕੇ ਸਰਕਾਰ ਵੱਲੋਂ ਚਲਾਈਆਂ ਹੋਈਆਂ ਸਕੀਮਾਂ ਲਾਭ ਬਹੁਤ ਜ਼ਿਆਦਾ ਦਿੰਦੀਆਂ ਹਨ ਇਸ ਨੂੰ ਅ ਇਸ ਵਿੱਚੋਂ ਲਾਭ ਉਠਾਉਣ ਲਈ ਬਸ ਕੁਝ ਨਹੀਂ ਕਰਨਾ ਪੈਂਦਾ ਆਧਾਰ ਕਾਰਡ ਜਾ ਅ ਵੋਟਰ ਅ ਆਧਾਰ ਕਾਰਡ ਜਾਂ ਪੈਨ ਕਾਰਡ ਲਿਜਾ ਕੇ ਕਿਸੇ ਵੀ ਸੁਵਿਧਾ ਨੇੜਲੇ ਸੁਵਿਧਾ ਕੇਂਦਰ ਦੇ ਵਿੱਚ ਅਸੀਂ ਇਸ ਬੀਮਾ ਯੋਜਨਾ ਨੂੰ ਬਣਵਾ ਸਕਦੇ ਹਾਂ ਧੰਨਵਾਦ